ਅਗਰ ਗੱਲ ਕਰਾਂ ਬਚਪਨ ਦੀ ਬਚਪਨ ਵਿੱਚ ਤਾਂ ਮੈਂ ਬਹੁਤ ਹੀ ਖੇਡਾਂ ਖੇਡੀਆਂ ਹਨ ਜਿਵੇਂ ਕਿ ਬੋਲੀਵਾਲ ਬੈਟ ਬੋਲ ਖੋ ਖੋ ਕਬੱਡੀ ਅਤੇ ਆਦਿ ਬਟ ਮੇਰੀ ਇਹਨਾਂ ਵਿੱਚੋਂ ਫੇਵਰੇਟ ਜਿਹੜੀ ਗੇਮ ਸ਼ੋ ਮੈਨੂੰ ਖੇਡਣਾ ਸਭ ਤੋਂ ਜ਼ਿਆਦਾ ਪਸੰਦ ਰਹੀ ਹੈ ਉਹ ਹੈ ਕ੍ਰਿਕਟ ਜੋ ਕਿ ਮੈਂ ਚੌਥੀ ਕਲਾਸ ਤੋਂ ਖੇਡਦਾ ਆ ਰਿਹਾ ਹਾਂ ਚੌਥੀ ਕਲਾਸ ਤੋਂ ਖੇਡਦੇ ਖੇਡਦੇ ਪਤਾ ਹੀ ਨਹੀਂ ਲੱਗਾ ਕਦੋਂ ਤੀਹ ਸਾਲ ਦੀ ਉਮਰ ਤੱਕ ਮੈਂ ਉਹੀ ਹੀ ਖੇਡੀ ਜਾ ਰਿਹਾ ਹਾਂ ਅਤੇ ਕੋਈ ਵੀ ਦਿਨ ਮਿਸ ਨਹੀਂ ਕਰਦਾ ਕਿ ਛੋਟੇ ਹੁੰਦਿਆਂ ਤਾਂ ਮੈਂ ਸਵੇਰੇ ਸਕੂਲ ਜਾਂਦਾ ਸੀਗਾ ਅਤੇ ਸਕੂਲ ਤੋਂ ਵਾਪਸ ਆਉਂਦਿਆਂ ਹੀ ਕ੍ਰਿਕਟ ਖੇਡਣ ਸੜੀ ਪੂਰੀ ਗਰਮੀ ਵਿੱਚ ਵੀ ਚਲਾ ਜਾਂਦਾ ਸੀ ਅਗਰ ਅਤੇ ਕੜਕਦੀ ਠੰਡ ਵਿੱਚ ਵੀ ਚਲਾ ਜਾਂਦਾ ਸੀਗਾ ਅੱਜ ਵੀ ਮੇਰਾ ਕ੍ਰਿਕਟ ਦੇ ਪ੍ਰਤੀ ਉੰਨਾ ਹੀ ਰੁਝਾਨ ਹੈ ਜੋ ਕਿ ਬਟ ਕੰਮ ਦੇ ਲੱਗਣ ਕਾਰਨ ਹੁਣ ਮੈਂ ਰੋਜ਼ ਤਾਂ ਨਹੀਂ ਜਾ ਪਾਉਂਦਾ ਜਿਹਦੇ ਕਾਰਨ ਮੈਂ ਸੈਟਰਡੇ ਅਤੇ ਸੰਡੇ ਰੋਜ਼ ਹਰ ਦਿਨ ਹਰ ਸੈਟਰਡੇ ਔਰ ਅਤੇ ਹਰ ਸੰਡੇ ਸਵੇਰੇ ਖੇਡਣ ਚਲਾ ਜਾਂਦਾ ਹਾਂ ਖੇਡਾਂ ਦੇ ਪ੍ਰਤੀ ਇੰਨਾ ਜ਼ਿਆਦਾ ਸ਼ੌਕੀਨ ਸੀਗਾ ਜੋ ਕਿ ਮੈਂ ਸਵੇਰੇ ਛੇ ਵਜੇ ਉੱਠ ਕੇ ਹੀ ਗਰਾਊਂਡ ਵਿੱਚ ਪਹੁੰਚ ਜਾਂਦਾ ਸੀਗਾ ਜਦੋਂ ਕਿ ਉੱਥੇ ਕੋਈ ਵੀ ਨਹੀਂ ਹੁੰਦਾ ਸੀਗਾ ਅਤੇ ਆਪਣੀ ਪਿੱਚ ਵਗੈਰਾ ਮੱਲ ਕੇ ਆਪਣੇ ਸਾਥੀਆਂ ਦੀ ਵੇਟ ਕਰਦਾ ਸੀਗਾ ਅਗਰ ਗੱਲ ਕਰਾਂ ਕ੍ਰਿਕਟ ਦੇ ਨਿਯਮਾਂ ਅਤੇ ਸ ਓ ਕਿਸਮਾਂ ਦੀ ਕ੍ਰਿਕਟ ਦੀਆਂ ਬਹੁਤ ਹੀ ਜ਼ਿਆਦਾ ਵਧੀਆ ਨਿਯਮ ਹੁੰਦੇ ਹਨ ਆਊਟ ਹੋਣ 'ਤੇ ਆਊਟ ਲਿੱਤਾ ਜਾਂਦਾ ਹੈ ਕੈਚ ਹੋਣ ਦੇ ਆਊਟ ਲਿੱਤਾ ਜਾਂਦਾ ਹੈ ਵਿਕਟਾਂ ਲਗਾਈਆਂ ਜਾਂਦੀਆਂ ਹਨ ਦੋਵੇਂ ਸਾਈਡਾਂ 'ਤੇ ਇੱਕ ਬੰਦਾ ਬੈਟਿੰਗ ਕਰਦਾ ਅਤੇ ਬਾਕੀ ਤਾਂ ਗਿਆਰਾਂ ਬੰਦੇ ਇੱਕ ਬੰਦਾ ਬੋਲਿੰਗ ਕਰਦਾ ਅਤੇ ਬਾਕੀ ਦਸ ਪਰਸ ਬੰਦੇ ਫੀਲਡਿੰਗ ਕਰਦੇ ਹਨ ਇੱਕ ਬੰਦਾ ਜਿਹੜਾ ਬੋਲ ਕਰਦਾ ਓ ਬੋ ਅ ਬੈਟਸਮੈਨ ਵੱਲ ਬੋਲ ਸੁੱਟਦਾ ਹੈ ਅਗਰ ਤਾਂ ਉਹ ਬੋਲ ਵਿਕਟ 'ਤੇ ਵੱਜ ਜਾਂਦੀ ਹੈ ਤਾਂ ਹਿੰਪਾਇਰ ਨੂੰ ਆਊਟ ਦੇਣਾ ਪੈਂਦਾ ਹੈ ਹੰਪਾਇਰ ਦੀ ਇੱਕ ਉਗਲ ਉਤਾਂਹ ਕਰਨ 'ਤੇ ਆਊਟ ਹੁੰਦਾ ਹੈ ਅਤੇ ਦੋ ਉਗਲਾਂ ਉਤਾਂਹ ਕਰਨ 'ਤੇ ਉਹਨੂੰ ਨੋਟ ਆਊਟ ਦਾ ਇਕ ਇਕ ਕਤਾਬ ਦਿੱਤਾ ਜਾਂਦਾ ਹੈ ਬੋਲਰ ਨੂੰ ਵੀ ਧਿਆਨ ਰੱਖਣਾ ਪੈਂਦਾ ਐ ਐ ਤਾਂ ਕਿ ਬੋ ਅ ਬੈਟਸਮੈਨ ਦੇ ਬੋਲ ਵਗੈਰਾ ਵੱਜ ਵਗੈਰਾ ਨਾ ਨਾ ਗਏ ਅਤੇ ਫੁੱਲ ਟਸ ਬੋਲ ਸੁੱਟਣ 'ਤੇ ਸਿੱਧੀ ਨੋ ਬੋਲ ਦਿੱਤੀ ਜਾਂਦੀ ਹੈ ਅਗਰ ਬੈਟਸਮੈਨ ਹਿਟ ਮਾਰਦਾ ਹੈ ਅਤੇ ਕੋਈ ਵੀ ਫੀਲਡਰ ਉਸ ਨੂੰ ਕੈਚ ਕਰ ਲੈਂਦਾ ਅਤੇ ਉਸ ਨੂੰ ਆਊਟ ਦਾ ਇਕਰਾਰ ਦਿੱਤਾ ਜਾਂਦਾ ਹੈ ਆਊਟ ਹੋਣ 'ਤੇ ਅਗਲਾ ਬੈਟਸਮੈਨ ਆਉਂਦਾ ਹੈ ਦੋਵੇਂ ਟੀਮਾਂ ਵਿੱਚ ਗਿਆਰਾਂ ਗਿਆਰਾਂ ਪਲੇਅਰ ਹੁੰਦੇ ਹਨ